ਸਾਡੇ ਮੁਤਾਬਕ ਤਾਰਿਆਂ ਅਤੇ ਬ੍ਰਹਿਮੰਡ ਦਾ ਅਧਿਐਨ ਕਰਕੇ ਅਸੀਂ ਕਾਫ਼ੀ ਕੁਛ ਸਿੱਖ ਸਕਦੇ ਹਾਂ ਜਿਵੇਂ ਕਿ ਹੁਣ ਸਾਇੰਸ ਇਹ ਖੋਜ ਕਰ ਰਹੀ ਹੈ ਕਿ ਕਿਤੇ ਹੋਰ ਬ੍ਰਹਿਮੰਡ ਦੇ ਵਿੱਚ ਕਿਸੇ ਹੋਰ ਜੋ ਕਿ ਗ੍ਰਹਿ ਹੈ ਉਹਦੇ ਉੱਪਰ ਜੀਵਨ ਕੀ ਮੌਜੂਦ ਹੈ ਕਿ ਕੋਈ ਪਾਣੀ ਦੀ ਜੋ ਅੋਕਸੀਜਨ ਜਾਂ ਕੋਈ ਇ ਇਹਨਾਂ ਜੋ ਗ੍ਰਹਿ ਹਨ ਇਹਨਾਂ 'ਤੇ ਅਵੇਲੇਬਲ ਹੈ ਅਤੇ ਇਹਦਾ ਇਹਨਾਂ ਤੋਂ ਹੋਰ ਵੀ ਆਪਾਂ ਕਈ ਅਧਿਐਨ ਕਰ ਸਕਦੇ ਹਾਂ ਜਿਵੇਂ ਕਿ ਮੌਸਮ ਪ੍ਰਤੀ ਜਾਂ ਹੋਰ ਇੱਦਾਂ ਦੇ ਕਈ ਅਧਿਐਨ ਚੱਲ ਰਹੇ ਹਨ ਸੋ ਕਿਵੇਂ ਜਿਵੇਂ ਕਿ ਲੋਕ ਲੋਕਾਂ ਵਿੱਚ ਕਈਆਂ ਵਿੱਚ ਇਹ ਵੀ ਮਿੱਥ ਚਾ ਚਾਹੇ ਮਿੱਥ ਇਹ ਸਮਝੀਏ ਚਾਹੇ ਸੱਚਾਈ ਸਮਝੀਏ ਕਿ ਵੀ ਹੋਰ ਗ੍ਰਹਿਆਂ ਦੇ ਉੱਤੇ ਜੋ ਕਿ ਏ ਏਲੀਅੰਨਸ ਮੌਜੂਦ ਹਨ ਉਹਦੀ ਵੀ ਖੋਜ ਚੱਲ ਰਹੀ ਹੈ